ਮੈਂ ਬਹੁਤ ਤਰ੍ਹਾਂ ਦੇ ਪੌਦੇ ਅਤੇ ਵੇਲਾਂ ਲਗਾਉਂਦੀ ਹਾਂ ਸਾਡਾ ਘਰ ਬਹੁਤ ਹੀ ਵੱਡਾ ਹੈ ਜਿਸ ਵਿੱਚ ਪਿਛਲੇ ਬੰਨੇ ਇੱਕ ਬਗੀਚਾ ਹੈ ਜਿੱਥੇ ਮੈਂ ਬਹੁਤ ਸਾਰੇ ਪੌਦੇ ਅਤੇ ਵੇਲਾਂ ਲਗਾਈਆਂ ਹਨ ਪਿਛਲੇ ਬੰਨੇ ਮੈਂ ਬਹੁਤ ਸਾਰੇ ਗਮਲੇ ਵੀ ਰੱਖੇ ਹਨ ਜਿੱਥੇ ਬਹੁਤ ਸਾਰੇ ਗੁਲਾਬ ਦੇ ਫੁੱਲ ਅਤੇ ਗੈਂਦੇ ਦੇ ਫੁੱਲ ਵੀ ਲਗਾਏ ਹਨ ਦੇਖਿਆ ਜਾਵੇ ਤਾਂ ਮੈਂ ਹੋਰ ਵੀ ਬਹੁਤ ਸਾਰੇ ਫੁੱਲ ਲਗਾਏ ਹਨ ਜਿਵੇਂ ਕਿ ਸੂਰਜਮੁਖੀ ਗੁੱਟੇ ਦਾ ਫੁੱਲ ਇਹ ਬਹੁਤ ਹੀ ਸੋਹਣੇ ਲੱਗਦੇ ਹਨ ਇਹ ਇਹ ਬਗੀਚੇ ਨੂੰ ਹੋਰ ਵੀ ਚਾਰ ਚੰਨ ਲਗਾਉਂਦੇ ਹਨ ਮੈਂ ਆਪਣੇ ਘਰ ਵਿੱਚ ਫਲਾਂ ਦੇ ਵੀ ਬੂਟੇ ਲਗਾਏ ਹਨ ਜਿਵੇਂ ਕਿ ਅਮਰੂਦ ਕਿੰਨੂਆਂ ਦੇ ਬੂਟੇ ਜਾਮੁਨ ਦਾ ਬਹੁਤ ਹੀ ਵੱਡਾ ਦਰੱਖਤ ਹੈ ਅੰਗੂਰ ਵੀ ਲੱਗਦੇ ਹਨ ਕੇਲੇ ਦਾ ਬਹੁਤ ਹੀ ਵੱਡਾ ਦਰੱਖਤ ਹੈ ਪਪੀਤਾ ਅਤੇ ਅਤੇ ਦੇ ਸਬਜ਼ੀਆਂ ਦੇ ਵੀ ਬਹੁਤ ਹੀ ਸਾਰੇ ਪੌਦੇ ਅਤੇ ਵੇਲਾਂ ਲਗਾਈਆਂ ਹਨ ਜਿਵੇਂ ਕਿ ਕਰੇਲੇ ਦਾ ਪੌਦਾ ਅਤੇ ਤੋਰੀਆਂ ਦੀ ਵੇਲ ਵੀ ਬਹੁਤ ਸੋਹਣੀ ਲਗਾਈ ਹੈ ਮੈਂ ਸਾਡੇ ਘਰੇ ਦਵਾਈਆਂ ਦੇ ਵੀ ਬੂਟੇ ਮਿਲ ਜਾਂਦੇ ਹਨ ਜਿਵੇਂ ਕਿ ਇੱਕ ਵਾਰ ਗੰਦਲ ਦਾ ਤੁਲਸੀ ਦਾ ਸੁਹੰਜਣਾ ਇਹ ਦਵਾਈਆਂ ਦੇ ਬਹੁਤ ਹੀ ਕੰਮ ਆਉਂਦਾ ਹੈ ਜਦੋਂ ਵੀ ਕੋਈ ਬਿਮਾਰ ਹੋਇਆ ਹੋਵੇ ਇਹ ਉਹਨਾਂ ਨੂੰ ਦਿੱਤਾ ਜਾਵੇ ਤਾਂ ਉਹਨਾਂ ਦੀ ਬਿਮਾਰੀ ਬਹੁਤ ਹੀ ਕੁਦਰਤੀ ਢੰਗ ਨਾਲ ਠੀਕ ਹੋ ਜਾਂਦੀ ਹੈ